ਹੈਲੋ ਹਾਂਜੀ ਹਾਂਜੀ ਮੈਮ ਦੱਸੋ ਹਾਂ ਹਾਂਜੀ ਮੈਮ ਸਭ ਕੁਛ ਮਿਲ ਜਾਂਦਾ ਹੈ ਹਾਂਜੀ ਸਪੋਰਟਸ ਸ਼ੂਜ ਆਪਣੇ ਕੋਲ ਹੈਗੇ ਆ ਹਾਂਜੀ ਪੈਰਾਡੋਨ ਦੀਆਂ ਚੱਪਲਾਂ ਪੰਜਾਬੀ ਜੁੱਤੀ ਵੀ ਮਿਲ ਜਾਂਦੀ ਹੈ ਤੇ ਹਾਂਜੀ ਮਿਲ ਜਾਣਗੇ ਹਾਂਜੀ ਮੈਮ ਹੋਵੇਗਾ ਤੁਹਾਨੂੰ ਕਲਰ ਵੀ ਅਲੱਗ ਅਲੱਗ ਚੋਇਸ ਦੇ ਮਿਲ ਜਾਣਗੇ ਮੈਮ ਆਪਣੀ ਸ਼ੋਪ ਦੀ ਓਪਨਿੰਗ ਹੁੰਦੀ ਹੈ ਸੁਬਹਾ ਨੌਂ ਤੋਂ ਸ਼ਾਮ ਨੂੰ ਦਸ ਵਜ੍ਹੇ ਤੱਕ ਅਤੇ ਤੁਹਾਨੂੰ ਸ਼ਾਮ ਛੇ ਵਜ੍ਹੇ ਤੱਕ ਤੁਹਾਨੂੰ ਆਪਣੀ ਸ਼ੋਪ 'ਤੇ ਰਸ਼ ਬਿਲਕੁਲ ਘੱਟ ਮਿਲੇਗਾ ਮੈਮ ਆਪਣੇ ਕੋਲ ਜਿੱਦਾਂ ਤੁਸੀਂ ਸ਼ੂਜ ਪੁੱਛਿਆ ਉਹਨਾਂ ਦਾ ਆਪਣੇ ਕੋਲ ਪੰਜ ਸੌ ਪ੍ਰਾਈਜ ਆ

ਮੈਮ ਉਹ ਆਪਣੇ ਕੋਲ ਹਜ਼ਾਰ ਬਾਰਾਂ ਕੁ ਸੌ ਤੱਕ ਦੀ ਰੇਂਜ ਤੱਕ ਵੀ ਹੁੰਦੇ ਆ ਜੇ ਤੁਸੀਂ ਥੋੜ੍ਹਾ ਜਿੱਦਾਂ ਮਟੀਰੀਅਲ ਦੇ ਹਿਸਾਬ ਨਾਲ ਜਿਵੇਂ ਸਸਤਾ ਮਟੀਰੀਅਲ ਹੁੰਦਾ ਉਸ ਦੇ ਹਿਸਾਬ ਨਾਲ ਪ੍ਰਾਈਜ਼ ਵੀ ਥੋੜ੍ਹਾ ਘੱਟ ਲੱਗੇਗਾ ਵਰਾਇਟੀਜ਼ ਉਹਦੇ 'ਚ ਹੁੰਦੀਆਂ ਹਾਂ ਹਾਂਜੀ ਹਾਂਜੀ ਆਪਣੇ ਕੋਲ ਮਤਲਬ ਲੇਡੀਜ਼ ਜੈਂਟਸ ਬੱਚਿਆਂ ਦੇ ਸਾਰੇ ਮਤਲਬ ਤਰ੍ਹਾਂ ਦੇ ਸ਼ੂਜ ਹੈਗੇ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਤੁਹਾਨੂੰ ਸ਼ੂਜ ਮਿਲ ਜਾਣਗੇ ਬੱਚੇ ਨੂੰ ਜਦੋਂ ਪਾਓਗੇ ਉਹਨਾਂ ਨੂੰ ਬਿਲਕੁਲ ਪਤਾ ਹੀ ਨਹੀਂ ਚੱਲੇਗਾ ਕਿ ਸ਼ੂਜ ਪਾਏ ਹੋਏ ਆ ਜਾਂ ਨਹੀਂ ਹਾਂਜੀ ਹਾਈ ਹੀਲਸ ਬੈਲੀਸ ਵੀ ਆਪਣੇ ਕੋਲ ਹੈਗੀਆਂ ਪਲੇਨ ਤੁਸੀਂ ਜਿੱਦਾਂ ਲੈਣਾ ਚਾਹੋ ਤਾਂ ਪਲੇਨ ਵਿੱਚ ਵੀ ਹੋ ਹੈਗੀਆਂ ਕੁਆਲਿਟੀ ਮੈਮ ਪਾਰਟੀ ਵੇਅਰ ਪਾਰਟੀ ਵੇਅਰ ਤੁਸੀਂ ਤੁਹਾਨੂੰ ਚਾਹੀਦਾ ਜਾਂ ਰੂਟੀਨ ਵਾਈਜ਼ ਕੋਈ ਆਪਣੀ ਚੋਇਸ ਠੀਕ ਮੈਮ ਉਹਦੇ ਵਿੱਚ ਆਪਣੇ ਕੋਲ ਹੈਗੇ ਆ ਜੋੜੇ ਤੁਸੀਂ ਤੁਸੀਂ ਕਦੋਂ ਤੱਕ ਵਿਜ਼ਿਟ ਕਰੋਂਗੇ ਸ਼ੋਪ 'ਤੇ

ਮੈਮ ਉਹਦੇ ਵਿੱਚ ਤੁਹਾਨੂੰ ਟਵੰਟੀ ਪਰਸੈਂਟ ਡਿਸਕਾਊਟ ਦੇਵਾਂਗੇ ਆਪਾਂ ਅਗਰ ਤੁਸੀਂ ਥ੍ਰੀ ਤਿੰਨ ਜੋੜੇ ਲਓਗੇ ਤਾਂ ਅਗਰ ਠੀਕ ਹੈ ਜੀ ਓਕੇ ਵਿਜ਼ਿਟ ਕਰਿਓ ਜ਼ਰੂਰ